ਹੋਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਿਹਤ ਕਿੱਦਾਂ ਠੀਕ ਆ ਭਾਅ ਜੀ ਭਾਅ ਜੀ ਸੁਮਿਤ ਬੋਲਦਾ ਸੀਗਾ ਮੈਂ ਅਤੇ ਆਪਣੇ ਲੱਕੀ ਢਾਬੇ ਤੋਂ ਸਾਨੂੰ ਪਤਾ ਤੁਹਾਡੀ ਤੁਹਾਡਾ ਖਾਣਾ ਆਪਾਂ ਨੂੰ ਵਧੀਆ ਲੱਗਦਾ ਹੋਰ ਢਾਬੇ ਤੋਂ ਕਦੇ ਔਡਰ ਹੀ ਨਹੀਂ ਕੀਤਾ ਤੁਹਾਨੂੰ ਪਤਾ ਹੀ ਆ ਅਤੇ ਤੁਹਾਡੇ ਤੁਹਾਡੇ ਤੋਂ ਆਪਾਂ ਆਡਰ ਕਰੀਦਾ ਦਸ ਬੰਦਿਆਂ ਦਾ ਖਾਣਾ ਆ ਭਾਅ ਜੀ ਆਪਣੇ ਉਹ ਜਿਹੜੇ ਪੁਰਾਣੇ ਪਤੇ 'ਤੇ ਨਾ ਭਾਅ ਜੀ ਭੇਜਿਓ ਆਪਾਂ ਹੋਰ ਕੋਠੀ ਲਈ ਆ ਕਪੂਰਥਲੇ ਰੋਡ 'ਤੇ ਮੇਨ ਰੋਡ 'ਤੇ ਲਈ ਕੋਠੀ ਆਪਣੇ ਹਨੂੰਮਾਨ ਮੰਦਰ ਦੇ ਸਾਹਮਣੇ ਆ ਹਾਂ ਉਹ ਹਨੂੰਮਾਨ ਮੰਦਰ ਦੇ ਬਿਲਕੁਲ ਸਾਹਮਣੇ ਕੋਠੀ ਆਪਣੀ ਉੱਥੇ ਲਈ ਆਪਾਂ ਕੋਠੀ ਉੱਥੇ ਦਸ ਬੰਦਿਆ ਦਾ ਭਾਅ ਜੀ ਖਾਣਾ ਭੇਜਿਓ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਆਪਣੇ ਉਹ ਸੁੱਕੀ ਸਬਜ਼ੀ ਭੇਜ ਦਿਓ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ